ਮੈਂ ਐਮਾਜ਼ੋਨ ਤੋਂ ਇੱਕ ਈ ਬੁੱਕ ਪਰਚੇਜ ਕੀਤੀ ਸੀ ਉਹ ਸੀ ਜੋਗਰਾਫ਼ੀ ਦੀ ਫੰਡਾਮੈਂਟਲਸ ਔਫ ਜੋਗਰਾਫ਼ੀ ਦੇ ਨਾਂ 'ਤੇ ਬੁੱਕ ਈ ਬੁੱਕ ਪਰਚੇਜ ਕੀਤੀ ਕੁਛ ਮੰਨਥ ਪਹਿਲਾਂ ਅਤੇ ਉਸ ਈ ਬੁੱਕ ਦੇ ਵਿੱਚ ਜਿਹੜੇ ਸੀ ਕੁਛ ਮੈਨੂੰ ਨੈਗਟਿਵ ਚੀਜ਼ਾਂ ਲੱਗੀਆਂ ਜੋ ਉਹਦੀ ਕੁਛ ਪੇਪਰ ਪੇਜਿਸ ਮਿਸ ਸੀਗੇ ਕੁਝ ਜਿਹੜੇ ਹੈਗੇ ਸੀਗੇ ਟਰਮਸ ਵਰਡਸ ਵਗੈਰਾ ਉਹ ਮਿਸ ਸੀਗੇ ਜਾਂ ਮਿਸਪ੍ਰਿੰਟ ਨੇ ਜਾਂ ਕੁਛ ਉਹ ਉੱਪਰ ਨੀਚੇ ਹੋਏ ਪਏ ਨੇ ਏਦਾਂ ਦਾ ਕੁਛ ਮੈਨੂੰ ਸਮੱਸਿਆ ਲੱਗੀ ਐਮਾਜ਼ੋਨ ਤੋਂ ਜੋ ਮੈਂ ਪ੍ਰੋਡਕਟਸ ਮੰਗਵਾਇਆ ਈ ਬੁੱਕ ਮੇਨਲੀ ਤਾਂ ਉੱਥੋਂ ਫਿਰ ਮੈਨੂੰ ਇਹ ਚੀਜ਼ ਹੋਈ ਵੀ ਨੈਕਸਟ ਟਾਈਮ ਤੋਂ ਜਿਹੜਾ ਹੈ ਐਮਾਜ਼ੋਨ ਤੋਂ ਕੋਈ ਵੀ ਈ ਬੁੱਕ ਵਗੈਰਾ ਮੈਂ ਪਰਚੇਜ ਨਹੀਂ ਕਰਾਂਗਾ ਇਹ ਮੇਰਾ ਬੜਾ ਹੀ ਇੱਕ ਨੈਗਟਿਵ ਜਿਹਾ ਜਿਹੜਾ ਹੈ ਐਕਸਪੀਰੀਅੰਸ ਰਿਹਾ ਉਹਦੇ ਰਿਗਾਰਡਿੰਗ